ਸਤਿ ਸ਼੍ਰੀ ਅਕਾਲ ਮੈਮ ਹਾਂਜੀ ਅੱਛਾ ਗੁਰਦਾਸਪੁਰ ਤਾਂ ਕਾਫੀ ਸਾਰੀਆਂ ਦੁਕਾਨਾਂ ਨੇ ਜਿਨ੍ਹਾਂ ਤੋਂ ਸਾਨੂੰ ਵਧੀਆ ਭੋਜਨ ਮਿਲਦਾ ਹੈ ਮਿਲਦੀਆਂ ਨੇ ਅਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਇੱਥੇ ਲਾਗੇ ਇੱਕ ਕਮਲ ਸਵੀਟਸ ਹੈ ਜਿਥੋਂ ਤੁਹਾਨੂੰ ਕਿ ਤੁਹਾਨੂੰ ਤਾਜ਼ੀਆਂ ਅਤੇ ਫਰੈਸ਼ ਸਵੀਟਸ ਮਿਲਣਗੀਆਂ ਇੱਕ ਸਾਡੇ ਕੋਲ ਫਾਸਟ ਫੂਡ ਦੀ ਦੁਕਾਨ ਵੀ ਹੈਗੀ ਏ ਜਿੱਦਾਂ ਕਿ ਆਨੰਦ ਫਾਸਟ ਫੂਡ ਉੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਫਾਸਟ ਫੂਡ ਮਿਲ ਜਾਏਗਾ ਉਹ ਹਰ ਇੱਕ ਵਰਾਈਟੀ ਜਿਵੇਂ ਕਿ ਇੰਡੀਅਨ ਜਾਂ ਨੋਰਥ ਇੰਡੀਅਨ ਹੋਵੇ ਅਤੇ ਇੱਕ ਸਾਡੇ ਕੋਲ ਸ਼੍ਰੀ ਰਾਧੇ ਹੈ ਚੌਂਕ ਦੇ ਲਾਗੇ ਉਹ ਵੀ ਗੁਰਦਾਸਪੁਰ ਦੇ ਵਿੱਚ ਹੀ ਉਥੋਂ ਵੀ ਤੁਹਾਨੂੰ ਸਾਰੀਆਂ ਹੀ ਚੀਜ਼ਾਂ ਦੇਸੀ ਘਿਓ ਦੀਆਂ ਬਣੀਆਂ ਹੋਈਆਂ ਮਿਲਣਗੀਆਂ ਹਾਂਜੀ ਮੈਮ ਠੀਕ ਹੈ ਤੁਸੀਂ ਜਦੋਂ ਵੀ ਆਓਗੇ ਮੈਨੂੰ ਇੱਕ ਵਾਰੀ ਫੋਨ ਕਰ ਲਿਓ ਓਕੇ ਬਾਏ